ਮੇਰਾ ਨਾਮ ਮੋਨੀਕਾ ਰਾਣੀ ਹੈ ਅੱਜ ਕੱਲ ਸਾਡੇ ਸਾਰੇ ਪਿੰਡਾਂ ਵਿੱਚ ਜਿੰਨੇ ਵੀ ਕਾਲਜ ਸਕੂਲ ਹਨ ਉੱਥੇ ਜ਼ਿਆਦਾਤਰ ਪੰਜਾਬੀ ਦੀ ਜਗ੍ਹਾ ਇੰਗਲਿਸ਼ ਮੀਡੀਅਮ ਸਿਖਾਉਂਦੇ ਹਨ ਜੋ ਕਿ ਬਹੁਤ ਗਲਤ ਹੈ ਅਸੀਂ ਸਾਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬੀ ਭਾਸ਼ਾ ਪੜ੍ਹਦੇ ਸੀ ਜੋ ਕਿ ਸਾਨੂੰ ਆਪਣੀ ਧਰਤੀ ਮਾਤਾ ਲਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੁਣ ਜ਼ਿਆਦਾਤਰ ਸਕੂਲਾਂ ਵਿੱਚ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਿਖਾਉਂਦੇ ਹਨ ਅਤੇ ਜੋ ਕਿ ਬਹੁਤ ਗਲਤ ਹੈ ਸਾਨੂੰ ਆਪਣੀ ਮਾਤ ਭਾਸ਼ਾ ਸਭ ਤੋਂ ਪਹਿਲਾਂ ਰੱਖਣੀ ਚਾਹੀਦੀ ਹੈ ਅਤੇ ਬੋਲਣੀ ਵੀ ਚਾਹੀਦੀ ਹੈ ਇਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਅਤੇ ਪ੍ਰੇਰਿਤ ਕੀਤਾ ਜਾਂਦਾ ਹੈ